ਪੰਜਾਬੀ ਭਾਸ਼ਾ ਸੱਤਵੀਂ ਸਦੀ ਤੋਂ ਦਸਵੀਂ ਸਦੀ ਤੱਕ ਸਥਾਪਿਤ ਕੀਤੀ ਗਈ ਸੀ ਗੁਰੂਆਂ ਪੀਰਾਂ ਨੇ ਵੀ ਪੰਜਾਬੀ ਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੀ ਸੀ ਸਮੇਂ ਦੇ ਨਾਲ ਪੰਜਾਬੀ ਭਾਸ਼ਾ ਹੌਲੀ ਹੌਲੀ ਵਿਕਸਤ ਹੋਈ ਪੰਜਾਬੀ ਭਾਸ਼ਾ ਫਿਲਮਾਂ ਦੇ ਵਿੱਚ ਵੀ ਬੋਲੀ ਜਾ ਰਹੀ ਹੈ ਸਿੰਗਰ ਵੀ ਗਾਣੇ ਪੰਜਾਬੀ ਬੋਲਦੇ ਹਨ ਇਸ ਤਰ੍ਹਾਂ ਪੰਜਾਬੀ ਭਾਸ਼ਾ ਬਾਹਰਲੇ ਦੇਸ਼ਾਂ ਵਿੱਚ ਵੀ ਹੁਣ ਲੋਕ ਬੋਲਦੇ ਹਨ ਅਤੇ ਆਪਣੇ ਬੱਚਿਆਂ ਨੂੰ ਸਿਖਾ ਰਹੇ ਹਨ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਭਾਸ਼ਾ ਹੈ ਇਸ ਕਰਕੇ ਹਰ ਇੱਕ ਪੰਜਾਬੀ ਦੇ ਦਿਲ ਵਿੱਚ ਵੱਸਦੀ ਹੈ ਅਤੇ ਅਤੇ ਬੋਲਣੀ ਵੀ ਚਾਹੀਦੀ ਹੈ ਇਸ ਕਰਕੇ ਬਾਹਰਲੇ ਦੇਸ਼ਾਂ ਵਿੱਚ ਪੰਜਾਬੀ ਲੋਕ ਵੀ ਇਸ ਨੂੰ ਨਹੀਂ ਭੁੱਲਦੇ ਅਤੇ ਆਪਣੇ ਬੱਚਿਆਂ ਨੂੰ ਸਿਖਾ ਰਹੇ ਹਨ ਜਿਸ ਕਰਕੇ ਹੌਲੀ ਹੌਲੀ ਪੰਜਾਬੀ ਭਾਸ਼ਾ ਵਿਕਸਿਤ ਹੋ ਗਈ ਅਤੇ ਇਹ ਅੱਗੇ ਵੀ ਅੱਗੇ ਵੀ ਦੇਸ਼ ਪੰਜਾਬ ਵਿੱਚ ਦੇਸ਼ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਵੇਗੀ